ਜਲੰਧਰ ਦੇ ਮੁੱਖ ਵਿੱਦਿਅਕ ਅਦਾਰੇ ਡੀਏਵੀ ਯੂਨੀਵਰਸਿਟੀ ਪੀਟੀਯੂ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਖਾਲਸਾ ਕਾਲਜ ਡੇਵੀਏਟ ਕਾਲਜ ਕੇਐਮਵੀ ਕਾਲਜ ਐਚ ਐਮ ਬੀ ਕਾਲਜ ਸਿਟੀ ਕਾਲਜ ਡੀਏਵੀ ਆਯੁਰਵੇਦਿਕ ਕਾਲਜ ਐਨਆਈਆਈਟੀ ਕਾਲਜ ਬੀਟੀਆ ਆਰਿਆ ਕਾਲਜ ਪ੍ਰਮੁੱਖ ਤੌਰ 'ਤੇ ਗਿਣੇ ਗਏ ਹਨ ਇਹਨਾਂ ਤੋਂ ਇਲਾਵਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਆਈਵੀ ਵਰਲਡ ਸਕੂਲ ਖਾਲਸਾ ਸਕੂਲ ਐਮਜੀਐਨ ਸਕੂਲ ਐਪੀਜੇ ਸਕੂਲ ਅਤੇ ਡੀਏਵੀ ਸਕੂਲ ਮੁੱਖ ਅਦਾਰੇ ਹਨ ਜੋ ਕਿ ਬੱਚਿਆਂ ਨੂੰ ਸ਼ੁਰੂਆਤੀ ਵਿੱਦਿਆ ਦਿੰਦੇ ਹਨ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕੰਪਿਊਟਰ ਦੀ ਸਿੱਖਿਆ ਪ੍ਰਮੁੱਖ ਤੌਰ 'ਤੇ ਗਿਣੀ ਗਈ ਹੈ ਇਸ ਤੋਂ ਇਲਾਵਾ ਮਕੈਨੀਕਲ ਸਿਵਲ ਇਲੈਕਟਰੋਨਿਕਸ ਇਲੈਕਟਰੀਕਲ ਕਮਰਸ ਅਤੇ ਲਿਟਰੇਚਰ ਦੇ ਸਬਜੈਕਟ ਹਨ ਨੋਰਮਲ ਹੀ ਬੱਚਿਆਂ ਦਾ ਰੁਝਾਨ ਕੰਪਿਊਟਰ ਦੀ ਸਿੱਖਿਆ ਵੱਲ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੰਪਿਊਟਰ ਮੁੱਖ ਤੌਰ 'ਤੇ ਜ਼ਰੂਰਤ ਹੈ ਅਗਰ ਅਸੀਂ ਫੀਸ ਦੀ ਗੱਲ ਕਰਦੇ ਹਾਂ ਤਾਂ ਪੀਟੀਯੂ ਕਾਲਜ ਦੀ ਫੀਸ ਬਾਕੀ ਕਾਲਜਾਂ ਦੇ ਨਾਲੋਂ ਵਧੀਆ ਗਿਣੀ ਗਈ ਹੈ ਜਿਸ ਦੇ ਵਿੱਚ ਹਰ ਪ੍ਰਕਾਰ ਦਾ ਸਟੂਡੈਂਟ ਸਿਖਲਾਈ ਲੈ ਸਕਦਾ ਹੈ ਇਸ ਤੋਂ ਇਲਾਵਾ ਆਯੁਰਵੇਦਿਕ ਕਾਲਜ ਦੇ ਵਿੱਚ ਵੀ ਬੜੀ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਬੜੀ ਕਫਾਇਤੀ ਫੀਸ ਰੱਖੀ ਗਈ ਹੈ ਜਿਸ ਦੇ ਨਾਲ ਕੀ ਬੱਚਿਆਂ ਨੂੰ ਹਰ ਇੱਕ ਲੈਵਲ ਦੇ ਉੱਤੇ ਸਿੱਖਿਆ ਪ੍ਰਾਪਤ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਬੱਚਿਆਂ ਨੂੰ ਪ੍ਰਮੁੱਖ ਤੌਰ 'ਤੇ ਖਾਲਸਾ ਸਕੂਲ ਜੋ ਕੀ ਬਹੁਤ ਹੀ ਵਧੀਆ ਸਿੱਖਿਆ ਪ੍ਰਦਾਨ ਕਰਦੇ ਨੇ ਇਸ ਦੇ ਵਿੱਚ ਬੱਚਿਆਂ ਨੂੰ ਵਜ਼ੀਫਾ ਵੀ ਦਿੱਤਾ ਜਾਂਦਾ ਹੈ ਜਿਹਦੇ ਨਾਲ ਕੀ ਹਰ ਵਰਗ ਦਾ ਸਟੂਡੈਂਟ ਜੋ ਹੈ ਵਧੀਆ ਤਰੀਕੇ ਦੇ ਨਾਲ ਆਪਣੀ ਵਿੱਦਿਆ ਪ੍ਰਾਪਤ ਕਰ ਸਕਦਾ